ਮੈਂ ਲਿਖਣ ਦੇ ਲਈ ਪ੍ਰੋਪਰ ਤਰੀਕੇ ਨਾਲ ਜਦੋਂ ਵੀ ਕੋਈ ਟੋਪਿਕ ਲਿਖਦੀ ਹਾਂ ਅਤੇ ਸਭ ਤੋਂ ਪਹਿਲਾਂ ਉਸ ਟੋਪਿਕ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਡਿਟੇਲ ਵਿੱਚ ਜਾਣਦੀ ਹਾਂ ਜਿਸ ਦੇ ਬਾਰੇ ਮੈਂ ਲਿਖਣਾ ਹੈ ਔਰ ਉਸਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਉਹਦੀ ਰੂਪ ਰੇਖਾ ਬਣਾ ਕੇ ਫਿਰ ਹੀ ਮੈਂ ਕਿਸੇ ਕੰਪਿਊਟਰ 'ਤੇ ਜਾਂ ਕੋਪੀ 'ਤੇ ਲਿਖਣਾ ਸਟਾਰਟ ਕਰਦੀ ਹਾਂ ਜਦੋਂ ਵੀ ਮੈਂ ਕਿਸੇ ਟੋਪਿਕ ਨੂੰ ਲਿਖਦੀ ਹਾਂ ਅਤੇ ਮੈਂ ਉਹਦਾ ਪ੍ਰੋਪਰ ਟੋਪਿਕ ਉਹਦੀ ਡਿਟੇਲ ਉਹਦੀ ਐਂਡਿੰਗ ਅਤੇ ਉਹਦੀ ਸਟਾਰਟਿੰਗ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੀ ਹਾਂ ਪਹਿਲਾਂ ਮੈਂ ਉਹਨੂੰ ਡਰਾਫਟ 'ਚ ਹੀ ਲਿਖਦੀ ਹਾਂ ਤਾਂ ਕਿ ਅਗਰ ਉਹਦੇ ਵਿੱਚ ਕੋਈ ਵੀ ਗਲਤੀਆਂ ਹੋ ਸਕਣ ਅਤੇ ਮੈਂ ਉਹਨਾਂ ਨੂੰ ਦੁਬਾਰਾ ਤੋਂ ਦੇਖ ਕੇ ਉਹਨਾਂ ਨੂੰ ਸੁਧਾਰ ਕਰ ਸਕਾਂ ਲਿਖਦੇ ਵਕਤ ਮੈਂ ਜ਼ਿਆਦਾਤਰ ਕੋਸ਼ਿਸ਼ ਕਰਦੀ ਹਾਂ ਕਿ ਜੋ ਮੈਂ ਲਿਖ ਰਹੀ ਹਾਂ ਉਸ ਨੂੰ ਪੜ੍ਹਨ ਵਾਲਾ ਉਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਇਸ ਲਈ ਲਿਖਣ ਤੋਂ ਪਹਿਲਾਂ ਮੇਰੇ ਲਈ ਇਹ ਜ਼ਿਆਦਾ ਇੰਪੋਰਟੈਂਟ ਰਹਿੰਦਾ ਹੈ ਕਿ ਮੇਰਾ ਟੋਪਿਕ ਕੀ ਹੈ ਅਤੇ ਉਸਨੂੰ ਮੈਂ ਕਿਸ ਤਰੀਕੇ ਦੇ ਨਾਲ ਲਿਖ ਸਕਦੀ ਹਾਂ ਸੋ ਮੈਂ ਜ਼ਿਆਦਾਤਰ ਪੋਇਟਰੀ ਲਿਖਣਾ ਵੀ ਪਸੰਦ ਕਰਦੀ ਹਾਂ ਕਵਿਤਾਵਾਂ ਦੇ ਨਾਲ ਮੈਨੂੰ ਬਹੁਤ ਪਿਆਰ ਹੈ ਅਤੇ ਮੈਂ ਇਸ ਦੇ ਲਈ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਦੇਖਦੀ ਹਾਂ ਮੈਂ ਉਹਨਾਂ ਦੀਆਂਂ ਕਵਿਤਾਵਾਂ ਤੋਂ ਬਹੁਤ ਸਾਰੀਆਂ ਕਵਿਤਾਵਾਂ ਤੋਂ ਪ੍ਰੇਰਨਾ ਲਈ ਹੈ ਜਿਸ ਤਰੀਕੇ ਨਾਲ ਉਹ ਲਿਖਦੇ ਨੇ ਉਹਨਾਂ ਦਾ ਲਿਖਣ ਦਾ ਤਰੀਕਾ ਔਰ ਉਹਨਾਂ ਦੇ ਮੈਸੇਜ ਦੇਣ ਦਾ ਤਰੀਕਾ ਬਹੁਤ ਵਧੀਆ ਹੈ ਉਹਨਾਂ ਦਾ ਇੰਨਾਂ ਰੋਚਕ ਜਿਹਾ ਤਰੀਕਾ ਦੇਖ ਕੇ ਮੈਂ ਵੀ ਕਦੇ ਕਦੇ ਕੋਸ਼ਿਸ਼ ਕਰਦੀ ਹਾਂ ਉਸ ਤਰੀਕੇ ਦੇ ਨਾਲ ਹੀ ਪੋਇਟਰੀ ਲਿਖਾਂ ਲਿਖਣ ਵਾਲੇ ਬੰਦੇ ਦੀ ਲਿਖਣ ਦੇ ਵਿੱਚ ਮੈਂ ਬਹੁਤ ਸਾਰੇ ਮੈਸੇਜ ਵੀ ਹੁੰਦੇ ਨੇ ਲਿਖਣਾ ਇੱਕ ਬਹੁਤ ਵੱਡੀ ਕਲਾ ਹੈ ਔਰ ਲਿਖਣ ਦੇ ਨਾਲ ਅੱਜ ਅਸੀਂ ਪੁਸਤਕਾਂ ਤੋਂ ਔਰ ਛੋ ਜਿੰਨੇ ਵੀ ਆਪਣੇ ਕੋਲ ਮੈਗਜ਼ੀਨਸ ਨੇ ਉਹਨਾਂ ਦੇ ਥਰੂ ਕਿੰਨਾ ਕੁਛ ਬੱਚੇ ਵੀ ਔਰ ਜਿੰਨੇ ਵੀ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਹਨ ਸਾਰੇ ਲਿਖੀਆਂ ਹੋਈਆਂ ਚੀਜ਼ਾਂ ਦੇ ਨਾਲ ਜੁੜੇ ਨੇ ਜਿਹਦੇ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿਸ ਤਰ੍ਹਾਂ ਉਹਨਾਂ ਦਾ ਵਰਤੋਂ ਕਰ ਸਕਦੇ ਹਾਂ ਸੋ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਦੇਖਦੇ ਹਾਂ